ਯੋਗਾ ਸਰੀਰਿਕ ਮਾਨਸਿਕ ਅਤੇ ਅਧਿਆਤਮਿਕ ਅਭਿਆਸਾਂ ਨੂੰ ਏਕੀਕ੍ਰਿਤ ਕਰਕੇ ਵਿਅਕਤੀਗਤ ਵਿਕਾਸ ਅਤੇ ਸਵੈ ਖੋਜ ਦੀ ਡੁੰਘਾਈ ਨਾਲ ਸਹੂਲਤ ਪ੍ਰਦਾਨ ਕਰ ਸਕਦਾ ਹੈ ਜੋ ਸੰਪੂਰਨ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੇ ਹਨ ਨਿਯਮਤ ਅਭਿਆਸ ਦੁਆਰਾ ਵਿਅਕਤੀ ਆਪਣੇ ਸਰੀਰ ਅਤੇ ਦਿਮਾਗ ਵਿੱਚ ਟਿਊਨਿੰਗ ਕਰਕੇ ਆਪਣੀਆਂ ਸੇਵਾਵਾਂ ਨੂੰ ਸਮਝ ਕੇ ਅਤੇ ਆਪਣੀ ਸਮਰੱਥਾ ਨੂੰ ਪਹਿਚਾਣ ਕੇ ਬਥੇਰੇ ਸਵੈ ਜਾਗਰੂਕਤਾ ਵਿਕਸਤ ਕਰ ਸਕਦੇ ਹਨ ਸਰੀਰਕ ਆਸਨ ਜਾਂ ਆਸਨ ਤਾਕਤ ਲਚਕਤਾ ਅਤੇ ਸੰਤੁਲਨ ਨੂੰ ਵਧਾਉਂਦੇ ਹਨ ਜੋ ਨਾ ਸਿਰਫ਼ ਸਮੁੱਚੀ ਸਹਿਤ ਨੂੰ ਸੁਧਾਰਦੇ ਹਨ ਬਲਕਿ ਲਚਕੀਲੇਪਨ ਅਤੇ ਅਨੁਸ਼ਾਸਨ ਨੂੰ ਵੀ ਵਧਾਉਂਦੇ ਹਨ ਯੋਗਾ ਦੇ ਧਿਆਨ ਦੇ ਪਹਿਲੂ ਜਿਸ ਵਿੱਚ ਸਾਹ ਨਿਰੰਤਨ ਅਤੇ ਮਨ ਚਿੰਤਾ ਸ਼ਾਮਲ ਹੈ ਮਨ ਨੂੰ ਸ਼ਾਂਤ ਕਰਨਾ ਤਣਾਅ ਘਟਾਉਣ ਅਤੇ ਅੰਦਰੂਨੀ ਸ਼ਾਂਤੀ ਦੀ ਡੂੰਘੀ ਭਾਵਨਾ ਪੈਦਾ ਕਰਨ ਵਿੱਚ ਮਦਦ ਕਰਦੀ ਹੈ ਇਹ ਆਤਮ ਨਿਰੀਖਣ ਵਿਅਕਤੀਆਂ ਨੂੰ ਨਿੱਜੀ ਚੁਣੌਤੀਆਂ ਅਤੇ ਭਾਵਨਾਤਮਕ ਬਲਾਕਾਂ ਦਾ ਸਾਹਮਣਾ ਕਰਨ ਅਤੇ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ ਜਿਸ ਨਾਲ ਬਥੇਰੇ ਸਵੈ ਸਵਿਤੀ ਕੇਤੀਆਂ ਅਤੇ ਸਪੱਸ਼ਟਤਾ ਹੁੰਦੀ ਹੈ ਇਸ ਤੋਂ ਇਲਾਵਾ ਯੋਗਾ ਦੀਆਂ ਦਾਰਸ਼ਨਿਕ ਸਿੱਖਿਆਵਾਂ ਹਮਦਰਦੀ ਧੀਰਜ ਅਤੇ ਅਟੈਚਮੈਂਟ ਵਰਗੀਆਂ ਕਦਰ ਕੀਮਤਾਂ ਨੂੰ ਉਤਸ਼ਾਹਿਤ ਕਰਦੀਆਂ ਹਨ ਜੋ ਨਿੱਜੀ ਵਿਕਾਸ ਦੀ ਅਗਵਾਈ ਕਰ ਸਕਦੇ ਹਨ ਅਤੇ ਆਪਸੀ ਸੰਬੰਧਾਂ ਨੂੰ ਮਜਬੂਤ ਕਰ ਸਕਦੇ ਹਨ ਕੁੱਲ ਮਿਲਾ ਕੇ ਯੋਗਾ ਵਿਅਕਤੀਗਤ ਖੋਜ ਅਤੇ ਵਿਕਾਸ ਲਈ ਇੱਕ ਵਿਆਪਕ ਢਾਂਚਾ ਪ੍ਰਦਾਨ ਕਰਦਾ ਹੈ ਜੋ ਵਿਅਕਤੀਆਂ ਨੂੰ ਬਥੇਰੇ ਸੰਤੁਲਿਤ ਸੰਪੂਰਨ ਅਤੇ ਸਵੈ ਜਾਗਰੂਕ ਜੀਵਨ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ